ਤਰਨ ਤਾਰਨ ਜ਼ਿਲ੍ਹੇ ਵਿੱਚ ਹਰ ਪ੍ਰਕਾਰ ਦਾ ਮੌਸਮ ਆਉਂਦਾ ਹੈ ਜਿੱਦਾਂ ਬਸੰਤ ਪਤਝੜ ਬਰਸਾਤ ਦਾ ਮੌਸਮ ਹੁੰਦਾ ਹੈ ਗਰਮੀਆਂ ਸਰਦੀਆਂ ਇੱਥੋਂ ਦੇ ਲੋਕ ਹਰ ਇੱਕ ਤਰ੍ਹਾਂ ਦੇ ਮੌਸਮ ਦਾ ਜਿਹੜਾ ਆਨੰਦ ਮਾਣਦੇ ਨੇ ਅਤੇ ਇਹਦੇ ਨਾਲ ਕੀ ਆ ਅਸਰ ਵੀ ਬਹੁਤ ਪੈਂਦਾ ਰੋਜ਼ਾਨਾ ਜੀਵਨ ਵਿੱਚ ਲੋਕਾਂ ਦੇ ਜਿਸ ਤਰ੍ਹਾਂ ਲੈ ਲਓ ਕਿ ਜਿਹੜਾ ਮੌਸਮ ਆ ਗਰਮੀਆਂ ਦੇ ਵਿੱਚ ਕੀ ਹੁੰਦਾ ਕਿ ਬਹੁਤ ਜ਼ਿਆਦਾ ਹਮਿਲਿਟੀ ਵੱਧ ਜਾਂਦੀ ਆ ਅਤੇ ਇਹਦੇ ਨਾਲ ਕੀ ਗਰਮੀਆਂ ਦੇ ਵਿੱਚ ਪਸੀਨਾ ਬਹੁਤ ਆਉਂਦਾ ਆ ਇਹਦੇ ਨਾਲ ਕੀ ਹੈ ਲੋਕਾਂ ਨੂੰ ਬੜੀ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ ਕੰਮ ਦਾ ਸਮਾਂ ਵੀ ਕਿਉਂਕਿ ਦਿਨ ਵੱਡੇ ਹੁੰਦੇ ਆ ਅਤੇ ਜਿਹੜਾ ਕੰਮ ਦਾ ਸਮਾਂ ਵੀ ਜਿਹੜਾ ਵਾ ਉਹ ਵੀ ਵੱਧ ਜਾਂਦਾ ਆ ਇਹਦੇ ਨਾਲ ਨਾਲ ਜਦੋਂ ਸਿਆਲ ਹੁੰਦਾ ਆ ਉਦੋਂ ਕੀ ਧੁੰਦਾ ਪੈਂਦੀਆਂ ਨੇ ਜਿਹਦੇ ਨਾਲ ਕਿ ਲੋਕ ਜਿਹੜੇ ਦਿਨੇ ਕੰਮ ਕਰਦੇ ਸੀਗੇ ਉਹਨਾਂ ਨੂੰ ਕੀ ਆ ਧੁੰਦ ਦੇ ਕਾਰਨ ਉਹਨਾਂ ਦੇ ਜਿਹੜਾ ਕੰਮ ਕਾਰਾਂ ਦੇ ਦਾ ਜਿਹੜਾ ਟਾਈਮ ਆ ਕੰਮ ਕਾਰ ਕੰਮ ਕਾਰ ਕਰਨ ਦਾ ਉਹ ਵੀ ਕੀ ਹੈ ਲੇਟ ਹੋ ਜਾਂਦਾ ਹੈ ਧੁੰਦ ਦੇ ਕਾਰਨ ਜਿਹੜੇ ਆ ਜਿਹੜੇ ਸਕੂਲਾਂ ਦਾ ਟਾਈਮ ਚੇਂਜ ਹੋ ਜਾਂਦਾ ਵਾ ਕੰਮ ਕਾਜ ਦਾ ਜਿਹੜਾ ਸਮਾਂ ਵਾ ਨਾ ਉਹ ਘੱਟ ਜਾਂਦਾ ਆ ਇਹ ਕੀ ਇਹਦੇ ਨਾਲ ਨਾਲ ਕੀ ਧੁੰਦ ਜਿਹੜੀ ਆ ਉਹ ਐਕਸੀਡੈਂਟ ਦਾ ਕਾਰਨ ਵੀ ਬਣਦੀ ਆ ਬਹੁਤ ਸਾਰੀਆਂ ਦੁਰਘਟਨਾ ਹੋ ਜਾਂਦੀਆਂ ਜਾਨਾਂ ਤੱਕ ਚਲ ਜਾਂਦੀਆਂ ਨੇ ਇਹਦੇ ਨਾਲ ਕੀ ਆ ਸਾਰਾ ਜਨਜੀਵਨ ਜੀਵਨ ਜਿਹੜਾ ਵਾ ਉਹ ਪ੍ਰਭਾਵਿਤ ਹੋ ਜਾਂਦਾ ਆ